ਹਾਂਜੀ ਹਾਂਜੀ ਮੈਂ ਬਹੁਤ ਵਾਰ ਲਾਈਵ ਮੋਡਲ ਬਣਾਏ ਹਨ ਸਕੂਲ ਵਿੱਚ ਡਰਾਇੰਗ ਕਰਦੇ ਸਮੇਂ ਮੇਰੀ ਟੀਚਰ ਮੈਨੂੰ ਇਸ ਤਰ੍ਹਾਂ ਡਰਾਇੰਗ ਕਰਵਾਉਂਦੇ ਸਨ ਕਿ ਜਿਵੇਂ ਸਾਹਮਣੇ ਕੋਈ ਕਿਤਾਬ ਉੱਤੇ ਸੇਬ ਰੱਖਿਆ ਹੋਵੇ ਉਵੇਂ ਹੀ ਆਪਣੀ ਡਰਾਇੰਗ ਸ਼ੀਟ ਵਿੱਚ ਦਿਖਾਉਣਾ ਦਿਖਾ ਸਕਦੀ ਹਾਂ